ਸਾਡਾ ਬ੍ਰਹਮੰਡ ਤੇਰ੍ਹਾਂ ਪੁਆਇੰਟ ਅੱਠ ਅਰਬ ਸਾਲ ਪੁਰਾਣਾ ਹੈ ਇਸਨੂੰ ਅਸੀਂ ਛੂਹ ਸਕਦੇ ਹਾਂ ਮਹਿਸੂਸ ਕਰ ਸਕਦੇ ਹਾਂ ਮਾਪ ਸਕਦੇ ਹਾਂ ਅਤੇ ਪਤਾ ਕਰ ਸਕਦੇ ਹਾਂ ਸਾਡੇ ਬ੍ਰਹਮੰਡ ਦੇ ਵਿੱਚ ਗ੍ਰਹਿ ਬੱਦਲ ਧੂੜ ਅਤੇ ਪ੍ਰਕਾਸ਼ ਪਾਏ ਜਾਂਦੇ ਹਨ ਸੂਰਜ ਵੀ ਗ੍ਰਹਿਆਂ ਦੇ ਵਿੱਚ ਆਉਂਦਾ ਹੈ ਅਤੇ ਸੂਰਜ ਦੇ ਨੌਂ ਗ੍ਰਹਿ ਹੋਰ ਹਨ ਜਦਕਿ ਹੁਣ ਕਿ ਅੱਠ ਗ੍ਰਹਿ ਰਹਿ ਚੁੱਕੇ ਹਨ ਸੂਰਜ ਇੱਕ ਸੌਰ ਮੰਡਲ ਦਾ ਇੱਕ ਗੋਲਾ ਹੈ ਇੱਕ ਕੇਂਦਰ ਬਿੰਦੂ ਹੈ ਜਿਸ ਤੋਂ ਸਾਨੂੰ ਪ੍ਰਕਾਸ਼ ਪ੍ਰਾਪਤ ਹੁੰਦਾ ਹੈ ਅਤੇ ਸਾਡੇ ਗ੍ਰਹਿਆਂ ਸੂਰਜ ਦੇ ਗ੍ਰਹਿਆਂ ਦਾ ਪ੍ਰਿਥਵੀ ਵੀ ਇੱਕ ਹਿੱਸਾ ਹੈ ਜਿਸ 'ਤੇ ਅਸੀਂ ਰਹਿੰਦੇ ਆ ਆਪਣਾ ਜੀਵਨ ਬਤੀਤ ਕਰਦੇ ਹਾਂ ਅਤੇ ਸੂਰਜ ਦੀ ਰੋਸ਼ਨੀ ਨਾਲ ਹੀ ਇਹ ਸਾਰਾ ਕੁਛ ਸੰਭਵ ਹੈ ਅਤੇ ਇਸੇ ਤਰ੍ਹਾਂ ਤਾਰੇ ਵੀ ਬ੍ਰਹਿਮੰਡ ਦਾ ਹਿੱਸਾ ਹਨ ਜੋ ਕਿ ਸਵੈ ਪ੍ਰਕਾਸ਼ਿਤ ਇੱਕ ਖਗੋਲਿਕ ਪਿੰਡ ਹਨ ਇੱਕ ਬਿੰਦੂ ਦੀ ਤਰ੍ਹਾਂ ਸਾਨੂੰ ਨਜ਼ਰ ਆਉਂਦੇ ਹਨ ਅਤੇ ਟੀਮ ਰਾਤ ਨੂੰ ਟਿਮ ਟਮਾਉਂਦੇ ਹਨ